ਅੰਮ੍ਰਿਤਸਰ ਜਿਲ੍ਹੇ ਵਿੱਚ ਬਹੁਤ ਸਾਰੇ ਅੱਜ ਕੱਲ੍ਹ ਉਦਯੋਗ ਚੱਲ ਰਹੇ ਨੇ ਜਿਵੇਂ ਕਿ ਅਸੀਂ ਕਹਿ ਸਕਦੇ ਹਾਂ ਲੋਕੀਂ ਬਾਹਰੋਂ ਦੀ ਆਉਂਦੇ ਨੇ ਉਹ ਟੂਰਿਜ਼ਮ ਦਾ ਵੀ ਹੈਗਾ ਉਹਦੇ ਕਰਕੇ ਟੂਰਿਜ਼ਮ ਦੇ ਆਉਣ ਕਰਕੇ ਇੱਥੋਂ ਦੀ ਜਿਹੜੀ ਮਸ਼ਹੂਰ ਚੀਜ਼ਾਂ ਨੇ ਜਿਵੇਂ ਖਾਣ ਪੀਣ ਦਾ ਪਾਪੜ ਵੜੀਆਂ ਹੋ ਗਈਆਂ ਫੁਲਕਾਰੀ ਦਾ ਦੁਪੱਟਾ ਹੋ ਗਿਆ ਸੂਟ ਹੋ ਗਿਆ ਕੁਛ ਲੋਕ ਪਾਕਿਸਤਾਨੀ ਸੂਟ ਵੀ ਮੰਗਦੇ ਨੇ ਇਸ ਕਰਕੇ ਇਹਨਾਂ ਦੀ ਜਿਹੜੀ ਉਦਯੋਗ ਜਿਹੜੀ ਹੋ ਰਹੀ ਹੈ ਉਹ ਹੁਣ ਵਿਕਸਿਤ ਹੋ ਰਹੇ ਨੇ ਹੋਟਲ ਮੈਨੇਜਮੈਂਟ ਜਿਹੜਾ ਉਹ ਬਹੁਤ ਜ਼ਿਆਦਾ ਵਿਕਸਿਤ ਹੋ ਰਿਹਾ ਹਰ ਕੋਈ ਆਪਣਾ ਹੋਟਲ ਬਣਾਉਣਾ ਚਾਹ ਰਿਹਾ ਆਪਣੇ ਬਿਲਕੁਲ ਦਰਬਾਰ ਸਾਹਿਬ ਦੇ ਕੋਲ ਬਹੁਤ ਸਾਰੇ ਹੋਟਲ ਜਿਹੜੇ ਨੇ ਉਹ ਤਿਆਰ ਹੋ ਚੁੱਕੇ ਹੋਏ ਨੇ ਜਿਹਦੇ ਕਰਕੇ ਕਿ ਲੋਕ ਆਉਂਦੇ ਨੇ ਦਰਬਾਰ ਸਾਹਿਬ ਮੱਥਾ ਟੇਕਦੇ ਨੇ ਫਿਰ ਉਸ ਤੋਂ ਬਾਅਦ 'ਚ ਸ਼ੌਪਿੰਗ ਕਰਦੇ ਨੇ ਜਿਹਦੇ ਕਰਕੇ ਇਸ ਤਰੀਕੇ ਨਾਲ ਜਿਹੜਾ ਉਦਯੋਗ ਇੱਥੇ ਸਭ ਦੁਕਾਨਦਾਰਾਂ ਦਾ ਆਰਥਿਕ ਵਿ ਵਿਕਾਸ ਜਿਹੜਾ ਉਹ ਹੁੰਦਾ ਘੁੰਮਦੇ ਨੇ ਉਹਦੇ ਨਾਲ ਖਾਂਦੇ ਨੇ ਪੀਂਦੇ ਨੇ ਇਸ ਕਰਕੇ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਾਫ਼ੀ ਜ਼ਿਆਦਾ ਚੱਲਦੀਆਂ ਨੇ ਬਾਕੀ ਅੰਮ੍ਰਿਤਸਰ ਵਾਸਤੇ ਜੋ ਮੇਨ ਹੈ ਉਹ ਦਰਬਾਰ ਸਾਹਿਬ ਹੈ ਅਤੇ ਵਾਹਗਾ ਬੋਡਰ ਹੈ ਉਹਦੇ ਕਰਕੇ ਜੋ ਵਿੱਚ ਜੋ ਜਿੰਨੇ ਵੀ ਆਉਂਦੇ ਨੇ ਆਪਣੇ ਉਦਯੋਗ ਉਹ ਸਾਰੇ ਹੀ ਚੱਲਦੇ ਨੇ ਇੱਥੇ ਕਾਰੋਬਾਰ ਟੈਕਸੀ ਦਾ ਬਹੁਤ ਜ਼ਿਆਦਾ ਵਧੀਆ ਚੱਲਦਾ ਬੱਸ ਜੀ